ਬਈ ਮੈਂ ਆਰਡਰ ਕੀਤੇ ਬੋਟ ਦੇ ਹੈੱਡਫੋਨ ਪੰਦਰਾਂ ਕੁ ਸੌ ਰੁਪਏ ਦੇ ਜਣੀ ਕਿ ਦੇਖਣ ਨੂੰ ਵਧੀਆ ਲੱਗੇ ਮੈਨੂੰ ਚਾਹੀਦੇ ਵੀ ਗੇਮਿੰਗ ਲਈ ਤੇ ਮੈਂ ਲੈ ਲਏ ਪਰ ਜਦੋਂ ਆਏ ਪਹਿਲਾਂ ਸ਼ੁਰੂ ਸ਼ੁਰੂ 'ਚ ਦੇਖਿਆ ਵੀ ਯਾਰ ਵਧੀਆ ਪੈਕਿੰਗ ਹੈ ਘੈਂਟ ਲੱਗਦੇ ਪਰ ਉਹਨਾਂ ਦੀ ਖਾਸ ਕੁਆਲਟੀ ਨਹੀਂ ਤੀ ਹੈਗੀ ਉਹਨਾਂ ਦੀ ਪਲਾਸਟਿਕ ਦੀ ਜਿਹੜੀ ਲੱਗੀ ਵੀ ਉਹ ਇੰਨੀ ਜੱਚਦੀ ਜਿਹੀ ਨਹੀਂ ਤੀ ਫੇਰ ਜਿਹੜੀ ਉਹਦੀ ਸ਼ਾਇਨ ਜਿਹੀ ਤੀ ਸਾਇਡਾਂ ਪਾ 'ਤੇ ਕੁੱਪਿਆਂ ਜਿਆਂ ਦੀ ਉਹ ਵੀ ਛੇਤੀ ਉਹ ਘੱਸ ਗਈ ਫਿਰ ਐਂ ਲੱਗਿਆ ਵੀ ਕਿਆ ਯਾਰ ਬੇਕਾਰ ਜਿਹੇ ਲੈ ਲਏ ਇਹ ਪਰ ਹੌਲੀ ਹੌਲੀ ਕਿਆ ਹੋਇਆ ਇੱਕ ਦਿਨ ਪਰਨੇ ਪਾ ਨੂੰ ਲੱਗਿਆ ਲਗਾਉਣ ਹੈੱਡਫੋਨਾਂ ਨੂੰ ਉਹ ਪਤੰਦਰ ਟੁੱਟ ਗਿਆ ਸਾਈਡ ਪਾ 'ਤੇ ਮੁੜਕੇ ਬੋਟ ਵਾਲਿਆਂ ਨੂੰ ਪਾਈ ਆਹਾ ਰਿਕੁਐਸਟ ਜਿਹੀ ਉਹਨੇ ਪਤੰਦਰਾਂ ਨੇ ਪਹਿਲਾਂ ਤਾਂ ਪੰਦਰਾਂ ਦਿਨ ਬਾਅਦ ਰਿਪਲਾਈ ਦਿਆ ਫੇਰ ਕਹਿੰਦੇ ਆਖ਼ੇ ਜੀ ਤੀਹ ਦਿਨ ਲੱਗ ਜੂਗੇ ਤੁਹਾਡੇ ਰਿਪਲੇਸ ਹੋਣ ਨੂੰ ਫੇਰ ਮੈਂ ਕਿਹਾ ਇਹ ਰਿਪਲੇਸ ਕਰਕੇ ਵੀ ਇਹੋ ਜਿਹੇ ਬੇਕਾਰ ਜਿਹੇ ਹੀ ਆਉਣੇ ਹੈ ਆਹੀ ਇਨ੍ਹਾਂ ਨੇ ਫੇਰ ਭੇਜ ਦੇਣੇ ਕਿਆ ਕਰਵਾਉਣਾ ਜਣੀ ਕਿ ਮੈਨੂੰ ਬੜੇ ਬੇਕਾਰ ਲੱਗੇ ਯਾਰ ਉਹ ਹੈੱਡਫੋਨ ਅਵਾਜ਼ ਵੀ ਇਹੋ ਜਿਹੀ ਉਹ ਖਾਸ ਨਹੀਂ ਤੀ ਹੈ ਕਦੇ ਕਦੇ ਬੇਸ ਚੱਲਣ ਲੱਗ ਜੇ ਕਰੇ ਕਦੇ ਪਟੀ ਜਿਹੀ ਉਹ ਅਵਾਜ਼ ਲੱਗਿਆ ਕਰੇ ਕਦੇ ਇੱਕ ਕੰਨ ਖਾਸੀ ਅਵਾਜ਼ ਛੱਡਿਆ ਕਰੇ ਇੱਕ 'ਚ ਨੂੂੰ ਕਈ ਵਾਰ ਅਵਾਜ਼ ਆਉਣ ਤੋਂ ਹੀ ਹੱਟ ਜਿਆ ਕਰੇ ਕਈ ਵਾਰ ਦੋਹੇਂ ਵੀ ਖੜ ਜਾਂਦੇ ਤੇ ਫਿਰ ਇੱਕ ਦੋ ਵਾਰ ਖੜਕਾਉਣ ਜੇ ਨਾਲ਼ ਫਿਰ ਚੱਲ ਪੈਂਦੇ ਤੇ ਇਹੋ ਜਿਹੇ ਉਹ ਹੈੱਡਫੋਨ ਤੇ ਅਤੇ ਇੱਕ ਦਿਨ ਤਾਂ ਉਹਦੀ ਜੋ ਤਾਰ ਹੁੰਦੀ ਜਿਹੜੀ ਉਹ ਜਿੱਥੇ ਫੋਨ 'ਚ ਫਸਾਉਂਦੇ ਹੈ ਉੱਥੇ ਤੇ ਵੀ ਕਰੈਕ ਜਿਹੀ ਹੋ ਗਈ ਤੀ ਜਣੀ ਕਿ ਕੋਈ ਖਾਸ ਗੱਲਬਾਤ ਜਿਹੀ ਨਹੀਂ ਹੈ ਯਾਰ ਉਹਨਾਂ ਹੈੱਡਫੋਨਾਂ 'ਚ ਪੈਸੇ ਦੀ ਬਰਬਾਦੀ ਉਹ ਹੈ ਪੈਸੇ ਫੁੱਕੇ ਬਸ ਹੋਰ ਕੁਛ ਨਹੀਂ